ਮੇਰਾ ਵਿਸ਼ੇਸ਼ ਹੁਨਰ ਕੁਕਿੰਗ ਕਰਨਾ ਹੈ ਮੈਂ ਛੋਟੇ ਹੁੰਦਿਆਂ ਤੋਂ ਹੀ ਕੁਕਿੰਗ ਵਿੱਚ ਬਹੁਤ ਇੰਨਟਰਸਟ ਰੱਖਦੀ ਸੀ ਜਦੋਂ ਮੈਂ ਆਪਣੀ ਮੰਮੀ ਨੂੰ ਖਾਣਾ ਬਣਾਉਦਿਆਂ ਦੇਖਣਾ ਤਾਂ ਫਿਰ ਬਾਅਦ ਵਿੱਚ ਮੈਂ ਖੁਦ ਉਸਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਪਰ ਹੁਣ ਮੈਂ ਚਾਈਨਿਸ ਡਿਸ਼ ਨੂਡਲ ਪਾਸਤਾ ਬਰਗਰ ਅਤੇ ਪੰਜਾਬੀ ਡਿਸ਼ ਸ ਚਟਣੀ ਸਰਸੋ ਦਾ ਸਾਗ ਮੱਕੀ ਦੀ ਰੋਟੀ ਕੜੀ ਪਕੋੜੇ ਆਦਿ ਬਣਾ ਸਕਦੀ ਹਾਂ ਪਰ ਹੁਣ ਮੇਰੇ ਘਰਦੇ ਮੇਰਾ ਹੱਥ ਦਾ ਬਣਿਆ ਹੋਇਆ ਖਾਣਾ ਬਹੁਤ ਪਸੰਦ ਕਰਦੇ ਹਨ